ਮੈਂ ਸੌਨੀ ਦਾ ਨਵਾਂ ਫ਼ੋਨ ਲੈ ਕੇ ਆਇਆ ਸੀ ਜਿਸ ਦੀਆਂ ਵਿਸ਼ੇਸ਼ਤਾਵਾਂ ਬਹੁਤ ਹੀ ਜ਼ਿਆਦਾ ਹਨ ਇਸਦੀ ਬੈਟਰੀ ਵੀ ਜਲਦੀ ਖਤਮ ਨਹੀਂ ਹੁੰਦੀ ਕੈਮਰਾ ਵੀ ਬਹੁਤ ਵਧੀਆ ਫੋਟੋਆਂ ਖਿੱਚਦਾ ਹੈ ਇਸ ਲਈ ਫ਼ੋਨ ਦਾ ਅਨੁਭਵ ਮੇਰੇ ਲਈ ਬਹੁਤ ਵਧੀਆ ਰਿਹਾ ਹੈ